ਭਾਰਤ ਵਿੱਚ ਜੋ ਬਾਲੀਵੁੱਡ ਹੈ ਉਸ ਵਿੱਚ ਡਾਂਸਰਾਂ ਦਾ ਬਹੁਤ ਪ੍ਰਭਾਵ ਹੈ ਕਿਉਂਕਿ ਬਹੁਤ ਸਾਰੀਆਂ ਫਿਲਮਾਂ ਜੋ ਬਣ ਰਹੀਆਂ ਹਨ ਉਹ ਡਾਂਸਰਾਂ ਦਾ ਉਸ ਵਿੱਚ ਬੜਾ ਮਹੱਤਵਪੂਰਨ ਰੋਲ ਹੁੰਦਾ ਹੈ ਕਿਉਂਕਿ ਬਹੁਤ ਸਾਰੇ ਗੀਤ ਹਿੱਟ ਹੋ ਜਾਂਦੇ ਹਨ ਉਹਦੇ 'ਚ ਜੋ ਡਾਂਸਰ ਹਨ ਉਹ ਇਸ ਫਿਲਮ ਨੂੰ ਸਫਲ ਕਰਨ ਦੇ ਵਿੱਚ ਮਹੱਤਵਪੂਰਨ ਰੋਲ ਅਦਾ ਕਰਦੇ ਹਨ ਕਿਉਂਕਿ ਬਗੈਰ ਗੀਤਾਂ ਤੋਂ ਕੋਈ ਵੀ ਹਿੰਦੀ ਪੰਜਾਬੀ ਜਾਂ ਕਿਸੇ ਵੀ ਭਾਸ਼ਾ ਵਿੱਚ ਬਣੀ ਫਿਲਮ ਅਧੂਰੀ ਹੁੰਦੀ ਹੈ ਇਸ ਕਰਕੇ ਗੀਤਾਂ ਦੇ ਨਾਲ ਨਾਲ ਜੋ ਡਾਂਸਰਾਂ ਦਾ ਜਿਹੜਾ ਹੈ ਉਹ ਬਹੁਤ ਪ੍ਰਭਾਵ ਹੁੰਦਾ ਹੈ ਬਾਲੀਵੁੱਡ ਫਿਲਮਾਂ ਦੇ ਵਿੱਚ ਕਿਉਂਕਿ ਜੋ ਡਾਂਸਰ ਹਨ ਉਹ ਆਪਣੀ ਜੋ ਕਲਾ ਰਾਹੀਂ ਮੰਨੋਰੰਜਨ ਵੀ ਕਰਦੇ ਹਨ ਅਤੇ ਉਹ ਉਹਦੇ ਕਰਕੇ ਕਾਫੀ ਸਾਰੀਆਂ ਫਿਲਮਾਂ ਜਿਹੜੀਆਂ ਉਹ ਹਿੱਟ ਵੀ ਹੋ ਜਾਂਦੀਆਂ ਹਨ ਇਸ ਕਰਕੇ ਬਾਲੀਵੁੱਡ ਵਿੱਚ ਡਾਂਸਰਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ